ਭਾਰਤ ਵਿੱਚ ਕਲਾਕਾਰਾਂ ਨੂੰ ਲੋੜੀਂਦਾ ਮਹੱਤਵ ਅਤੇ ਮੌਕੇ ਪ੍ਰਦਾਨ ਨਹੀ ਹੁੰਦੇ ਕਿਉਂਕਿ ਇਹਨਾਂ ਕਲਾਕਾਰਾਂ ਦੀ ਜਗ੍ਹਾ ਹੋਰ ਬਹੁਤ ਸਾਰੇ ਨਵੇਂ ਉੱਠ ਰਹੇ ਕਲਾਕਾਰਾਂ ਨੇ ਲੈ ਲਈ ਹੈ ਭਾਈ ਵੀਰ ਸਿੰਘ ਮੋਹਨ ਸਿੰਘ ਸੁਰਜੀਤ ਪਾਤਰ ਵਰਗੇ ਕਲਾਕਾਰ ਆਪਣੀਆਂ ਰਚਨਾਵਾਂ ਵਿੱਚ ਪੰਜਾਬ ਨਾਲ ਇੱਕਜੁੱਟ ਰੱਖਣ ਲਈ ਇਕਜੁੱਟ ਰੱਖਣ ਲਈ ਆਪਣੀਆਂ ਕਿਤ ਕਵਿਤਾਵਾਂ ਵਿੱਚ ਜ਼ਿਕਰ ਕਰਦੇ ਸਨ ਉਹ ਆਪਣੀਆਂ ਕਵਿਤਾਵਾਂ ਵਿੱਚ ਪੰਜਾਬ ਦੇ ਦ੍ਰਿਸ਼ ਪੰਜਾਬ ਵਿੱਚ ਕੀ ਵਾਪਰ ਰਿਹਾ ਹੈ ਉਹਨਾਂ ਬਾਰੇ ਲਿਖਦੇ ਸਨ ਉਹ ਜਿਸ ਵੀ ਜਗ੍ਹਾ ਵਿੱਚ ਜਾਂਦੇ ਸਨ ਉੱਥੋਂ ਦੇ ਦ੍ਰਿਸ਼ ਵਿੱਚ ਆਪਣੀਆਂ ਰਚਨਾਵਾਂ ਵਿੱਚ ਲਿਖਦੇ ਸਨ ਅਤੇ ਲੋਕਾਂ ਸਾਹਮਣੇ ਪੇਸ਼ ਕਰਦੇ ਸਨ ਪਰ ਅੱਜ ਕੱਲ ਨਵੇਂ ਉੱਠ ਰਹੇ ਕਲਾਕਾਰਾਂ ਨੇ ਉਹਨਾਂ ਦੀ ਜਗ੍ਹਾ ਲੈ ਲਈ ਹੈ ਉਹ ਆਪਣੀਆਂ ਰਚਨਾਵਾਂ ਵਿੱਚ ਲੜਾਈਆਂ ਝਗੜਿਆਂ ਬਾਰੇ ਬਿਆਨ ਕਰਦੇ ਹਨ ਭਾਈ ਵੀਰ ਸਿੰਘ ਵਰਗੇ ਸੁਰਜੀਤ ਪਾਤਰ ਵਰਗੇ ਕਲਾਕਾਰਾਂ ਨੇ ਪੰਜਾਬ ਨੂੰ ਇੱਕਜੁੱਟ ਰੱਖਣ ਲਈ ਆਪਣੀਆਂ ਕਵਿਤਾਵਾਂ ਵਿੱਚ ਜ਼ਿਕਰ ਕੀਤਾ ਹੈ ਇਹਨਾਂ ਵਰਗੇ ਕਲਾਕਾਰਾਂ ਨੂੰ ਹੁਣ ਘੱਟ ਹੀ ਮਹੱਤਵ ਮਿਲਦਾ ਹੈ ਕਿਉਂਕਿ ਉੱਠ ਰਹੇ ਨਵੇਂ ਕਲਾਕਾਰ ਆਪਣੀਆਂ ਰਚਨਾਵਾਂ ਰਾਹੀਂ ਇਹਨਾਂ ਰਚਨਾਵਾਂ ਨੂੰ ਦੱਬ ਰਹੇ ਹਨ ਇੱਕ ਬੇਰੁਜ਼ਗਾਰੀ ਕਰਨਾ ਵੀ ਕਲਾਕਾਰਾਂ ਨੂੰ ਲੋੜੀਂਦਾ ਮਹੱਤਵ ਨਹੀਂ ਮਿਲਦਾ ਨਵੇਂ ਉੱਠ ਰਹੇ ਕਲਾਕਾਰਾਂ ਨੇ ਆਪਣੀਆਂ ਰਚਨਾਵਾਂ ਨਾਲ ਜੋ ਆਪਣੀਆਂ ਰਚਨਾਵਾਂ ਨਾਲ ਭਾਈ ਵੀਰ ਸਿੰਘ ਵਰਗੀਆਂ ਕਵਿਤਾਵਾਂ ਉੱਤੇ ਬਹੁਤ ਜ਼ਿਆਦਾ ਦਬਾਅ ਪਾ ਲਿਆ ਹੈ ਇਸ ਕਰਕੇ ਭਰਤ ਵਿੱਚ ਕਲਾਕਾਰਾਂ ਨੂੰ ਲੋੜੀਂਦਾ ਮਹੱਤਵ ਅਤੇ ਮੌਕੇ ਘੱਟ ਪ੍ਰਦਾਨ ਹੁੰਦੇ ਹਨ